ਟਰੈਕਿੰਗ ਕਰਨ ਦੌਰਾਨ ਮੈਂ ਦੇਖਿਆ ਕਿ ਲੋਕਾਂ ਨੇ ਬਹੁਤ ਹੀ ਜ਼ਿਆਦਾ ਕੂੜਾ ਕਰਕਟ ਫੈਲਾਇਆ ਹੋਇਆ ਹੈ ਅਤੇ ਆਲੇ ਦੁਆਲੇ ਦੇ ਪ੍ਰਦੂਸ਼ਣ ਨੂੰ ਖਰਾਬ ਕੀਤਾ ਹੋਇਆ ਹੈ ਵਾਤਾਵਰਨ ਬਹੁਤ ਖਰਾਬ ਹੋ ਜਾਂਦਾ ਹੈ ਜਦੋਂ ਆਪਾਂ ਟਰੈਕਿੰਗ ਕਰਦੇ ਸਮੇਂ ਗੰਦ ਪਾਉਂਦੇ ਹਾਂ ਸਾਨੂੰ ਚਾਹੀਦਾ ਹੈ ਕਿ ਜਦੋਂ ਆਪਾਂ ਟਰੈਕਿੰਗ ਕਰਦੇ ਹਾਂ ਅਤੇ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖੀਏ ਜਦੋਂ ਵੀ ਆਪਾਂ ਕੁਝ ਖਾਈਏ ਅਤੇ ਪੈਕਟਾਂ ਨੂੰ ਇੱਕ ਪੋਲੀਥਲ ਦੇ ਵਿੱਚ ਪਾ ਲਈਏ ਕੇਲੇ ਖਾ ਕੇ ਲੋਕ ਸਾਈਡਾਂ 'ਤੇ ਸੁੱਟੀ ਜਾਂਦੇ ਸੀ ਅਤੇ ਬਹੁਤ ਜ਼ਿਆਦਾ ਗੰਦ ਪਾ ਰਹੇ ਸੀ ਇੱਕ ਬੰਦਾ ਤਾਂ ਕੇਲੇ ਦੇ ਸ਼ਿਕੜ ਉੱਤੇ ਡਿਗ ਪਿਆ ਅਤੇ ਮੈਂ ਵੇਖਿਆ ਕਿ ਉਹਦੀ ਲੱਤ ਫੈਰੈਕਚਰ ਹੋ ਗਈ ਦੇਖੋ ਕਿੰਨਾ ਨੁਕਸਾਨ ਹੁੰਦਾ ਹੈ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਾਡੀ ਸਰਕਾਰ ਨੂੰ ਚਾਹੀਦਾ ਕਿ ਹਰ ਬੰਦੇ ਨੂੰ ਵਾਤਾਵਰਨ ਨੂੰ ਸਾਫ ਰੱਖਣ ਲਈ ਯੋਗਦਾਨ ਦਿੱਤਾ ਜਾਵੇ ਇੱਕ ਬੰਦਾ ਪੂਰੇ ਵਾਤਾਵਰਨ ਨੂੰ ਸਾਫ ਨਹੀਂ ਰੱਖ ਸਕਦਾ ਇਸ ਕਰਕੇ ਸਾਨੂੰ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਇੱਕ ਬੰਦੇ ਨੂੰ ਇੱਥੇ ਦੱਸਿਆ ਜਾਵੇ ਕਿ ਟਰੈਕਿੰਗ ਦੇ ਦੌਰਾਨ ਵਾਤਾਵਰਨ ਨੂੰ ਸਾਫ ਰੱਖਿਆ ਕਿਵੇਂ ਜਾ ਸਕਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਸਿਹਤ 'ਤੇ ਅਸਰ ਪੈਂਦਾ ਹੈ ਜੇਕਰ ਸਾਡਾ ਵਾਤਾਵਰਨ ਸਾਫ ਸੁਥਰਾ ਹੋਵੇਗਾ ਅਤੇ ਸਾਡੇ ਲੋਕ ਵੀ ਸਾਫ ਸੁਥਰੇ ਰਹਿਣਗੇ ਅਤੇ ਉਹਨਾਂ ਦੀ ਸਿਹਤ ਵੀ ਪ੍ਰਭਾਵ ਚੰਗਾ ਪਵੇਗਾ ਕਿਉਂਕਿ ਸਾਫ ਵਾਤਾਵਰਨ ਹੀ ਸਿਹਤ ਉੱਤੇ ਸਭ ਤੋਂ ਵੱਡਾ ਅਸਰ ਪਾਉਂਦਾ ਹੈ